ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਸਮਾਜ ਵਿੱਚ ਹੁਣ ਆਮ ਹੋ ਗਈਆਂ ਹਨ ਪਿਛਲੇ ਹੀ ਦਿਨੀਂ ਸਾਡੇ ਪਿੰਡ ਵਿੱਚ ਵੀ ਇੱਕ ਅਜਿਹੀ ਘਟਨਾ ਵਾਪਰੀ ਸਾਡੇ ਪਿੰਡ ਦੇ ਇੱਕ ਅਮੀਰ ਜਗੀਰਦਾਰ ਦੇ ਘਰ ਅੱਧੀ ਰਾਤੀ ਚੋਰ ਆ ਵੜੇ ਚੋਰਾਂ ਨੇ ਇੱਕ ਇੱਕ ਕਰਕੇ ਪਹਿਲਾਂ ਸਭ ਨੂੰ ਨਸ਼ੇ ਵਾਲੀ ਦਵਾਈ ਸੁੰਘਾ ਕੇ ਅਤੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਇੱਕ ਇੱਕ ਕਰਕੇ ਜੋ ਕੁਝ ਵੀ ਉਹਨਾਂ ਨੂੰ ਉਹਨਾਂ ਦੇ ਘਰ ਕੀਮਤੀ ਸਮਾਨ ਲੱਭਾ ਉਹ ਉਹਨੂੰ ਚੁੱਕ ਕੇ ਲੈ ਗਏ ਸਵੇਰੇ ਜਦੋਂ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਜਾਗ ਖੁੱਲ੍ਹੀ ਤਾਂ ਉਹ ਆਪਣੇ ਘਰ ਦੀ ਹਾਲਤ ਵੇਖ ਕੇ ਹੈਰਾਨ ਹੋ ਗਏ ਉਹਨਾਂ ਨੇ ਫਟਾਫਟ ਪਹਿਲਾਂ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਹਨਾਂ ਨੂੰ ਬੁਲਾਇਆ ਪੁਲਿਸ ਦੇ ਆਉਣ ਤੱਕ ਤਾਂ ਸਾਰਾ ਪਿੰਡ ਹੀ ਉਹਨਾਂ ਦੇ ਘਰ ਇਕੱਠਾ ਹੋ ਚੁੱਕਾ ਸੀ ਸਾਰੇ ਪਿੰਡ ਨੇ ਪੁਲਿਸ 'ਤੇ ਜ਼ੋਰ ਦੇ ਕੇ ਉਨਾਂ ਨੂੰ ਕਿਹਾ ਕਿ ਉਹਨਾਂ ਨੂੰ ਚੋਰ ਕਿਸੇ ਵੀ ਹਾਲਤ ਵਿੱਚ ਚਾਹੀਦਾ ਹੈ ਕਿਉਂਕਿ ਅੱਜ ਜੇ ਇਸ ਘਟਨਾ ਦੇ ਬਾਅਦ ਵੀ ਉਹਨਾਂ ਚੋਰਾਂ ਨੂੰ ਨਾ ਫੜਿਆ ਜਾਵੇ ਅਤੇ ਕੱਲ੍ਹ ਉਹ ਪਿੰਡ ਦੇ ਕਿਸੇ ਹੋਰ ਘਰ ਜਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣਗੇ ਪਿੰਡ ਦੇ ਲੋਕਾਂ ਦੀ ਇਹ ਗੱਲ ਸੁਣ ਕੇ ਅਫਸਰ ਨੇ ਉਹਨਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਆਪਣੀ ਤਰਫ ਤੋਂ ਹਰ ਮੁਮਕਿਨ ਕੋਸ਼ਿਸ਼ ਕਰਨਗੇ ਉਹਨਾਂ ਚੋਰਾਂ ਨੂੰ ਫੜਨ ਦੀ ਅਤੇ ਸਜ਼ਾ ਦਵਾਉਣ ਦੀ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਤਲਾਸ਼ ਵਿੱਚ ਉਹਨਾਂ ਨੂੰ ਦੋ ਦਿਨ ਬਾਅਦ ਉਹ ਚੋਰ ਮਿਲ ਗਏ ਚੋਰਾਂ ਨੂੰ ਫੜ ਕੇ ਪੁਲਿਸ ਸਟੇਸ਼ਨ ਲਿਆਉਂਦਾ ਗਿਆ ਅਤੇ ਫਿਰ ਜਗੀਰਦਾਰ ਵੀ ਉਹਨਾਂ ਨੂੰ ਵੇਖਣ ਗਿਆ ਪੁਲਿਸ ਨੇ ਬੜੀ ਦੇਰ ਤਿਕਨ ਉਹਨਾਂ ਤੋਂ ਸਵਾਲ ਜਵਾਬ ਕੀਤੇ ਅਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜਗੀਰਦਾਰ ਦੇ ਘਰ ਦਾ ਸਮਾਨ ਕਿੱਥੇ ਹੈ ਪਰ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ ਬਾਅਦ 'ਚ ਉਹਨਾਂ ਨੂੰ ਪਤਾ ਚੱਲਾ ਕਿ ਉਹਨਾਂ ਨੇ ਤਾਂ ਸਾਰਾ ਸਮਾਨ ਹੀ ਵੇਚ ਦਿੱਤਾ ਹੈ ਹੁਣ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਜਾ ਸਕਦਾ ਸੀ ਪੁਲਿਸ ਨੇ ਉਹਨਾਂ ਨੂੰ ਆਪਣੇ ਕੋਲ ਜੇਲ ਵਿੱਚ ਰੱਖਿਆ ਅਤੇ ਜਗੀਰਦਾਰ ਵਿਚਾਰੇ ਮਾਯੂਸ ਹੋ ਕੇ ਘਰ ਵਾਪਸ ਆ ਗਏ